ਮੈਂ ਫਿਲਮਾਂ ਦੇਖਣ ਵਾਸਤੇ ਕਦੀ ਵੀ ਨੈੱਟਫਲਿਕਸ ਜਾਂ ਪ੍ਰਾਈਮਰੀ ਵਰਗੀ ਨਹੀਂ ਸੇਵਾਵਾਂ ਦੀ ਵਰਤੋਂ ਕੀਤੀ ਕੇਬਲ ਜਾਂ ਸੈਟੇਲਾਈਟ ਟੀ ਵੀ ਦੀ ਤੁਲਨਾ ਇਹ ਮੈਨੂੰ ਥੋੜ੍ਹਾ ਘੱਟ ਪਸੰਦ ਹੈ ਟੀ ਵੀ 'ਤੇ ਸ ਕੇਬਲ ਮੈਨੂੰ ਜ਼ਿਆਦਾ ਸੈਟੇਲਾਈਟ ਪਸੰਦ ਹੈ ਤਾਂ ਕਿ ਜਿਹੜੀਆਂ ਮੈਨੂੰ ਖਬਰਾਂ ਨਵੀਆਂ ਮਿਲਣੀਆਂ ਲਾਈਵ ਨਿਊਜ਼ ਮਿਲਦੀਆਂ ਉਹ ਮੈਨੂੰ ਉੱਥੋਂ ਹੀ ਪ੍ਰਾਪਤ ਹੋ ਜਾਂਦੀਆਂ ਹਨ